ਮੈਂ ਆਪਣੇ ਸਾਈਕਲ ਦੀ ਬਹੁਤ ਦੇਖਭਾਲ ਕਰਦੀ ਹਾਂ ਕਿਉਂਕਿ ਮੈਂ ਇਸ 'ਤੇ ਬਹੁਤ ਦੂਰ ਤੱਕ ਕਈ ਵਾਰ ਟੂਰ ਕੱਢਣਾ ਹੁੰਦਾ ਹੈ ਸਾਈਕਲ ਦੀ ਦੇਖਭਾਲ ਵਿੱਚ ਉਸ ਵਿੱਚ ਉਸ ਦੇ ਟਾਇਰਾਂ ਵਿੱਚ ਹਵਾ ਚੈੱਕ ਕਰਨੀ ਉਸਦੇ ਚੇਨ ਨੂੰ ਗਰੀਸ ਦੇਣੀ ਇਹ ਕਈ ਚੀਜ਼ਾਂ ਦਾ ਧਿਆਨ ਰੱਖਣਾ ਪੈਂਦਾ ਹੈ ਸਾਈਕਲ ਚਲਾਉਣ ਨਾਲ ਕਈ ਵਾਰ ਥਕਾਵਟ ਹੋ ਸਕਦੀ ਹੈ ਪਰ ਉਸ ਲਈ ਬਹੁਤ ਸਾਰੇ ਐਨਰਜੀ ਬੂਸਟਰ ਆਉਂਦੇ ਹਨ ਜੋ ਅਸੀਂ ਥੋੜ੍ਹੇ ਥੋੜ੍ਹੇ ਟਾਈਮ ਬਾਅਦ ਜੇਕਰ ਲੈਂਦੇ ਰਹੀਏ ਤਾਂ ਸਾਨੂੰ ਉਹ ਥਕਾਵਟ ਮਹਿਸੂਸ ਨਹੀਂ ਹੁੰਦੀ ਲੰਬੇ ਰੂਟ 'ਤੇ ਜਾਣ ਲਈ ਆਪਾਂ ਨੂੰ ਸੁਚੇਤ ਰਹਿਣਾ ਚਾਹੀਦਾ ਹੈ ਅਤੇ ਉਹ ਮੈਨੂੰ ਇਸ ਲਈ ਪ੍ਰੇਰਿਤ ਕਰਦਾ ਹੈ ਕਿਉਂਕਿ ਉਸ ਦੇ ਨਾਲ ਤੁਹਾਡੀ ਫਿਟਨੈਸ ਬਣੀ ਰਹਿੰਦੀ ਹੈ ਅਤੇ ਤੁਹਾਨੂੰ ਕੋਈ ਜੇਕਰ ਪ੍ਰੋਬਲਮ ਆਉਂਦੀ ਹੈ ਤਾਂ ਉਹ ਵੀ ਤੁਸੀਂ ਕਿਵੇਂ ਹੈਂਡਲ ਕਰਨੀ ਹੈ ਉਹ ਤੁਹਾਨੂੰ ਪਤਾ ਲੱਗਦਾ ਹੈ ਇਸਦੇ ਨਾਲ ਤੁਹਾਡੀ ਫਿਟਨੈਸ ਬਣੀ ਰਹਿੰਦੀ ਹੈ ਅਤੇ ਤੁਹਾਨੂੰ ਅੱਗੇ ਜਾ ਕੇ ਵੀ ਕੋਈ ਮੁਸ਼ਕਿਲ ਦਾ ਸਾਹਮਣਾ ਨਹੀਂ ਕਰਨਾ ਪੈਂਦਾ